ਪੰਜਾਬ ਵਿੱਚ ਕਈ ਮਨੋਰੰਜਨ ਸਥਾਨ ਹਨ ਜੋ ਲੋਕ ਸੈਲਾਨੀ ਪੰਜਾਬ ਦੇਖਣ ਆਉਂਦੇ ਹਨ ਉਹ ਸਾਡਾ ਪੰਜਾਬ ਵੀ ਦੇਖ ਸਕਦੇ ਹਨ ਉਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ ਗਿਆ ਹੈ ਜਿਸ ਵਿੱਚ ਪੰਜਾਬੀ ਸੱਭਿਆਚਾਰ ਭੰਗੜਾ ਵੀ ਹੈ ਅਤੇ ਪੰਜਾਬੀ ਸੱਭਿਆਚਾਰਕ ਪਹਿਰਾਵਾ ਅਤੇ ਰਿਵਾਇਤਾਂ ਵੀ ਦਰਸਾਈਆਂ ਗਈਆਂ ਹਨ ਉੱਥੇ ਪੰਜਾਬੀ ਸੱਭਿਆਚਾਰਕ ਖਾਣਾ ਵੀ ਹੈ ਜੋ ਕਿ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਹੈ ਉੱਥੇ ਫੁੱਲ ਕਾਰੀ ਦੀਆਂ ਕਢਾਈਆਂ ਕੱਢਦੀਆਂ ਮੁਟਿਆਰਾਂ ਵੀ ਦਿਖਾਈਆਂ ਗਈਆਂ ਹਨ ਇਹ ਅੰਮ੍ਰਿਤਸਰ ਵਿੱਚ ਸਥਿਤ ਹੈ ਇਸ ਤਰ੍ਹਾਂ ਇੱਕ ਹੋਰ ਸਥਾਨ ਹੈ ਜੋ ਕਿ ਸਾਈਸ ਸਿਟੀ ਕਪੂਰਥਲਾ ਵਿੱਚ ਹੈ ਉੱਥੇ ਸਾਨੂੰ ਬੱਚਿਆਂ ਨੂੰ ਦਿਖਾਉਣ ਲਈ ਲੈ ਕੇ ਜਾਣਾ ਚਾਹੀਦਾ ਹੈ ਇਹ ਬੱਚਿਆਂ ਦੀ ਪੜ੍ਹਾਈ ਵਿੱਚ ਵਾਧਾ ਕਰਦੀ ਹ ਹਨ ਇਹ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰਦੀ ਹੈ ਇਸ ਨਾਲ ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਵਾਧਾ ਹੁੰਦਾ ਹੈ ਅਤੇ ਇੱਕ ਹੋਰ ਮਨੋਰੰਜਨ ਸਥਾਨ ਹੈ ਜੋ ਕਿ ਵੰਡਰਲੈਂਡ ਹੈ ਜਲੰਧਰ ਵਿੱਚ ਹੈ ਉੱਥੇ ਬੱਚੇ ਅਤੇ ਸਿਆਣੇ ਲੋਕ ਵੀ ਜਾ ਸਕਦੇ ਹਨ ਉੱਥੇ ਪਾਣੀ ਦੀਆਂ ਸਲਾਈਡ ਵੀ ਹੈ ਅਤੇ ਹੋਰ ਵੀ ਕਈ ਸਾਰੇ ਝੂਟੇ ਹਨ